ਸਭ ਤੋਂ ਪਹਿਲਾਂ ਜਿੱਦਾਂ ਮੇਰਾ ਮੇਰਾ ਬਹੁਤ ਵਧੀਆ ਐਕਸਪੀਰੀਐਂਸ ਰਿਹਾ ਹੈ ਹੁਣ ਤੱਕ ਔਨਲਾਈਨ ਦਾ ਕੱਪੜੇ ਖਰੀਦਣ ਦਾ ਅਤੇ ਮੈਂ ਸਟੋਰ ਜਿਹੜੇ ਵੀ ਸਟੋਰ ਜਿਹੜੇ ਹੈਗੇ ਨੇ ਸਟੋਰ ਲਈ ਮੈਂ ਇਹ ਹੀ ਦੇਣਾ ਚਾਹਵਾਂ ਗਾ ਫੀਡਬੈਕ ਦੇਣਾ ਚਾਹਵਾਂ ਗਾ ਕਿ ਬਈ ਦੇਖੋ ਉਨ੍ਹਾਂ ਨੂੰ ਚਾਹੀਦਾ ਆਉਣ ਵਾਲੇ ਟਾਈਮ ਦੇ ਅੰਦਰ ਆਪਣੇ ਜਿਹੜੇ ਕੱਪੜੇ ਨੇ ਚਾਹੇ ਐਮਾਜੋਨ ਫਲਿੱਪਕਾਟ ਜਾਂ ਜਾਂ ਕਹਿ ਸਕਦੇ ਹਾਂ ਅਸੀਂ ਮੀਸ਼ੋ ਡੋਟ ਕੋਮ 'ਤੇ ਜਾ ਕੇ ਅਪਲੋਡ ਕਰਨ ਜਿਹਦੇ ਨਾਲ ਪਬਲਿਕ ਨੂੰ ਔਰ ਅਵੇਰਨੈੱਸ ਮਿਲੇ ਅਤੇ ਮੈਂ ਚਾਹਵਾਂ ਗਾ ਕਿ ਜਿਹੜੇ ਔਨਲਾਈਨ ਜਿਹੜਾ ਅੱਜ ਦੀ ਡੇਟ 'ਚ ਕੰਮ ਚੱਲ ਰਿਹਾ ਹੈ ਉਹ ਬਹੁਤ ਹੀ ਵਧੀਆ ਹੈ ਅਤੇ ਨਾਲ ਨਾਲ ਸ਼ੋਪ ਵੀ ਚਲਾਉਣ ਅਤੇ ਨਾਲ ਨਾਲ ਓਨਲੈਨ ਮਾਰਕਿਟਿੰਗ ਵੀ ਕਰਨ ਮੈਂ ਇਨ੍ਹਾਂ ਨੂੰ ਸਭ ਨੂੰ ਸਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹਵਾਂ ਗਾ ਕਿ ਔਨਲਾਈਨ ਵੀ ਜਾ ਕੇ ਖਰੀਦਣ ਕਿਉਂਕਿ ਉਹਦੇ ਨਾਲ ਸਾਡਾ ਟਾਈਮ ਬਚਦਾ ਹੈ ਅਤੇ ਸਾਨੂੰ ਕੋਈ ਨਾ ਕਿੱਥੇ ਨਾ ਕਿੱਥੇ ਅਸੀਂ ਕਹਿ ਸਕਦੇ ਹਾਂ ਕਿ ਡਿਫਰੈਂਸ ਸਮਝ ਆ ਜਾਂਦਾ ਕਿੰਨੀ ਕੋਸਟ ਮਾਰਕੀਟ ਦੇ ਅੰਦਰ ਕੱਪੜਿਆਂ ਦੇ ਅੰਦਰ ਮਿਲ ਰਹੀ ਹੈ ਅਤੇ ਇਹਨੂੰ ਵੋਟਿੰਗ ਮੈਂ ਹੰ ਟੈੱਨ ਟੂ ਟੈੱਨ ਦੇਣਾ ਚਾਹਵਾਂ ਗਾ